ਮੈਂ ਪਟਿਆਲਾ ਸ਼ਹਿਰ ਵਿੱਚ ਰਹਿੰਦੀ ਹਾਂ ਸਾਡੇ ਘਰ ਦੇ ਨੇੜੇ ਰਸੋਈਆਂ ਬਹੁਤ ਹਨ ਮੈਂ ਤਾਂ ਕਦੇ ਗਈ ਨਹੀਂ ਐ ਮੇਰੀ ਬੇਟੀ ਗਈ ਇੱਕ ਵਾਰੀ ਜੋ ਕਿ ਸਿੱਖਣ ਵਾਸਤੇ ਉੱਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਇਹਨੂੰ ਸਬਜ਼ੀਆਂ ਕੱਟਣੀਆਂ ਸਿਖਾਈਆਂ ਉਸ ਤੋਂ ਬਾਅਦ 'ਚੋਂ ਇਹਨੂੰ ਸਬਜ਼ੀਆਂ ਪ ਖਾਣਾ ਬਣਾਉਣਾ ਸਿਖਾਇਆ ਕਈਆਂ ਨੂੰ ਤਾਂ ਉਹ ਸਰਟੀਫਿਕੇਟ ਵੀ ਦਿੰਦੇ ਹਨ ਜੋ ਕਿ ਹੋਟਲਾਂ ਵਿੱਚ ਜਾਂ ਰੈਸਟੋਰੇਟਾਂ ਵਿੱਚ ਖਾਣਾ ਬਣਾਉਣ ਦਾ ਕੰਮ ਕਰਦੇ ਹਨ ਉਨ੍ਹਾਂ ਨੂੰ ਪੈਸੇ ਵੀ ਵਧੀਆ ਮਿਲਦੇ ਹਨ ਅਤੇ ਖਾਣਾ ਵਧੀਆ ਬਣਾਉਂਦੇ ਹਨ ਅਤੇ ਜੋ ਕਿ ਉਨ੍ਹਾਂ ਲਈ ਵਧੀਆ ਹਨ